ਹਾਂਜੀ ਅੱਜ ਕੱਲ੍ਹ ਫੈਸ਼ਨ ਅਤੇ ਦਿਖਾਵੇ ਦਾ ਦੌਰ ਹੈ ਲੋਕ ਦਿਖਾਵੇ ਪਿੱਛੇ ਭੱਜੇ ਹੀ ਫਿਰਦੇ ਨੇ ਲੋਕਾਂ ਵਿੱਚ ਦਿਖਾਵੇ ਦੀ ਇੰਨੀ ਕੁ ਹੋੜ ਲੱਗੀ ਹੋਈ ਹੈ ਕਿ ਉਹ ਪੈਸੇ ਦੀ ਵੀ ਪਰਵਾਹ ਨਹੀਂ ਕਰਦੇ ਉਹਨਾਂ ਨੂੰ ਪੈਸਾ ਜਿੰਨਾ ਮਰਜ਼ੀ ਖਰਚਣਾ ਪਵੇ ਉਹਨਾਂ ਦੇ ਫੈਸ਼ਨ ਦੀ ਜਿਹੜੀ ਹੈ ਮਨ ਦੀ ਤਸੱਲੀ ਹੋਣੀ ਚਾਹੀਦੀ ਹੈ ਅੱਜ ਕੱਲ੍ਹ ਰੇਡੀਮੇਡ ਕੱਪੜਿਆਂ ਦੀ ਬਜ਼ਾਰਾਂ ਵਿੱਚ ਭਰਮਾਰ ਹੈ ਕੋਈ ਵੀ ਦੁਕਾਨ ਲੈ ਲਓ ਕੋਈ ਛੋਟੀ ਦੁਕਾਨ ਹੈ ਵੱਡੀ ਹੈ ਮੋਲ ਹੈ ਇੰਨੀ ਜ਼ਿਆਦਾ ਵਰਾਇਟੀ ਸਾਨੂੰ ਉੱਥੇ ਦੇਖਣ ਨੂੰ ਮਿਲਦੀ ਹੈ ਜੋ ਕਿ ਲੋਕਾਂ ਨੂੰ ਪਸੰਦ ਆਉਂਦੀ ਹੈ ਰੇਡੀਮੇਡ ਕੱਪੜੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਆਕਰਸ਼ਿਤ ਕਰਦੇ ਹਨ ਕਿਉਂਕਿ ਇਸ ਵਿੱਚ ਜਿਹੜਾ ਆ ਚਮ ਚਮਕਦਾਰ ਕੱਪੜਾ ਲੱਗਿਆ ਹੁੰਦਾ ਆ ਮੋਤੀ ਲੈਸਾਂ ਲਟਕਣ ਆਦਿ ਇਸ ਤਰੀਕੇ ਨਾਲ਼ ਵਰਤੇ ਹੁੰਦੇ ਨੇ ਜੋ ਕਿ ਉਹਨਾਂ ਨੂੰ ਬਹੁਤ ਹੀ ਸੋਹਣੇ ਲੱਗਦੇ ਨੇ ਅਤੇ ਉਹ ਉਹਨਾਂ ਵੱਲ ਖਿੱਚੇ ਜਾਂਦੇ ਨੇ ਪਰ ਜੇ ਰੇਡੀਮੇਡ ਕੱਪੜਿਆਂ ਦੀ ਗੁਣਵੱਤਾ ਨੂੰ ਵੇਖੀਏ ਤਾਂ ਇਹ ਕੱਪੜੇ ਇੰਨੇ ਹੰਢਣਸਾਰ ਨਹੀਂ ਹੁੰਦੇ ਅਤੇ ਦੂਜੇ ਆਮ ਕੱਪੜਿਆਂ ਨਾਲੋਂ ਘਰ ਬਣਾਏ ਕੱਪੜਿਆਂ ਨਾਲ਼ੋਂ ਇਹ ਸਾਨੂੰ ਸਸਤੇ ਵੀ ਮਿਲ ਜਾਂਦੇ ਨੇ ਪਰ ਅਜੋਕੇ ਫੈਸ਼ਨ ਦੇ ਦਿਖਾਵੇ ਦੀ ਹੋੜ ਨੂੰ ਇਹ ਕੱਪੜੇ ਜਿਹੜੇ ਨੇ ਜ਼ਰੂਰ ਪੂਰੀਆਂ ਕਰ ਦਿੰਦੇ ਨੇ ਅਤੇ ਦੂਜੇ ਪਾਸੇ ਜੇ ਅਸੀਂ ਵੇਖੀਏ ਤਾਂ ਜਿਹੜੇ ਹੱਥੀਂ ਕੱਪੜੇ ਬਣਾਏ ਬਣਾਉਣ ਦੇ ਲਈ ਸਾਨੂੰ ਖੁਦ ਕੱਪੜਾ ਖਰੀਦਣਾ ਪੈਂਦਾ ਆ ਡਿਜ਼ਾਇਨ ਪਸੰਦ ਕਰਨਾ ਪੈਂਦਾ ਆ ਆਪਣੇ ਨਾਪ ਦਾ ਜਿਹੜਾ ਆ ਸਵਾਉਣਾ ਪੈਂਦਾ ਆ ਅਤੇ ਇਹ ਫਿਰ ਦੂਸਰਾ ਹੈ ਸਾਨੂੰ ਬੁਟੀਕ ਵਾਲਾ ਟੇਲਰ ਚੰਗਾ ਟੱਕਰਦਾ ਹੈ ਕਿ ਨਹੀਂ ਟੱਕਰਦਾ ਸਾਡੇ ਨਾਪ ਦੇ ਸਾ ਅਨੁਸਾਰ ਕੱਪੜਾ ਬਣਾ ਕੇ ਦਿੰਦਾ ਹੈ ਕਿ ਨਹੀਂ ਦਿੰਦਾ ਠੀਕ ਹੈ ਅਤੇ ਰੇਡੀਮੇਡ ਕੱਪੜਿਆਂ ਦਾ ਮੁਕਾਬਲਾ ਜਿਹੜਾ ਆ ਇਹ ਕੱਪੜੇ ਨਹੀਂ ਕਰ ਸਕਦੇ ਕਿਉਂਕਿ ਟੇਲਰ ਜਿਹੜੇ ਨੇ ਸਿਉਂਣ ਦੇ ਵਿੱਚ ਵੀ ਸਾਨੂੰ ਕਾਫ਼ੀ ਟਾਈਮ ਲਗਾਉਂਦੇ ਨੇ ਅਤੇ ਕੋਈ ਨਾ ਕੋਈ ਕਮੀ ਛੱਡ ਹੀ ਦਿੰਦੇ ਨੇ ਅਤੇ ਰੇਡੀਮੇਡ ਕੱਪੜਿਆਂ ਵਿੱਚ ਸਾਡੇ ਕੋਲ ਬਹੁਤ ਜ਼ਿਆਦਾ ਵਰਾਇਟੀ ਅਤੇ ਚੋਣ ਉਪਲੱਬਧ ਹੁੰਦੀ ਹੈ ਇਸ ਤੋਂ ਇਲਾਵਾ ਹੱਥੀਂ ਕੱਪੜੇ ਜਿਹੜੇ ਤਿਆਰ ਕਰਵਾਉਣ ਲਈ ਸਾਨੂੰ ਕਾਫ਼ੀ ਸਮਾਂ ਲੱਗਦਾ ਆ ਕਿੰਨੇ ਕਿੰਨੇ ਦਿਨ ਬੁਟੀਕਾਂ ਵਾਲਿਆਂ ਦੇ ਸਾਨੂੰ ਚੱਕਰ ਮਾਰਨੇ ਪੈਂਦੇ ਨੇ ਉਹ ਸਿਲਾਈ ਕਰਕੇ ਕੱਪੜਾ ਸਮੇਂ ਸਿਰ ਵਾਪਸ ਨਹੀਂ ਦਿੰਦੇ ਫਿਰ ਸਟਿਚਿੰਗ ਦੀ ਕੀਮਤ ਵੀ ਸਾਨੂੰ ਕਾਫ਼ੀ ਦੇਣੀ ਪੈਂਦੀ ਹੈ ਇਸ ਦੇ ਉਲਟ ਰੇਡੀਮੇਡ ਕੱਪੜਾ ਜੇ ਸਾਨੂੰ ਕਿਤੇ ਐਮਰਜੈਂਸੀ 'ਚ ਜਾਣਾ ਵੀ ਪੈਂਦਾ ਅਤੇ ਦੁਕਾਨ 'ਤੇ ਜਾਓ ਕੱਪੜਾ ਖਰੀਦੋ ਅਤੇ ਪਾਓ ਅਤੇ ਵੇਖਣ ਵਾਲਾ ਵੀ ਖੁਸ਼ ਅਤੇ ਪਾਉਣ ਵਾਲਾ ਵੀ ਖੁਸ਼ ਇਸ ਵਿੱਚ ਸਾਨੂੰ ਜ਼ਿਆਦਾ ਖੇਚਲ ਮਹਿਸੂਸ ਨਹੀਂ ਹੁੰਦੀ ਇਸ ਲਈ ਲੋਕ ਜਿਹੜੇ ਨੇ ਰੇਡੀਮੇਡ ਕੱਪੜਿਆਂ ਦੀ ਵਰਤੋਂ ਨੂੰ ਪਹਿਲ ਦਿੰਦੇ ਨੇ